ਸ਼ਰਮਾ ਸ਼ੂ ਹਾਊਸ ਤੋਂ ਬੋਲਦੇ ਹੋ ਜੀ ਬਰਨਾਲੇ ਤੋਂ ਹੰਡਿਆਏ ਤੋਂ ਬੋਲਦੇ ਆ ਸਰ ਅਸੀਂ ਇੱਕ ਨਾ ਜੀ ਦਸ ਆਪਣੇ ਵਿਆਹ ਸੀਗਾ ਫੈਮਿਲੀ 'ਚ ਜੀ ਉਹਦੇ ਸ਼ੁ ਵਗੈਰਾ ਲੈ ਕੇ ਜਾਣੇ ਸੀਗੇ ਕਿਹੜੇ ਕਿਹੜੇ ਬ੍ਰਾਂਡ ਮਿਲ ਜਾਣਗੇ ਜੀ ਆਪਣੇ ਕੋਲ ਅੱਛਾ ਜੀ ਕੀ ਔਫਰ ਵਗੈਰਾ ਚਲ ਰਹੀ ਹੈ ਆਪਣੇ ਕੋਲ ਅੱਛਾ ਜੀ ਦੋ ਜੋੜੇ ਲੈਂਦੇ ਜੇ ਠੀਕ ਹੈ ਜੀ ਠੀਕ ਹੈ ਅਤੇ ਇੱਕ ਲੇਡੀ ਦੇ ਵਗੈਰਾ ਵੀ ਮਿਲ ਜਾਂਦੇ ਨੇ ਆਪਣੇ ਕੋਲ ਸ਼ੂਜ਼ ਵਗੈਰਾ ਉਹ ਲੈਦਰ ਦੇ ਚਾਹੀਦੇ ਹੋਣਗੇ ਜੀ ਅੱਛਾ ਜੀ ਸੈਂਡਲ ਵਗੈਰਾ ਹੈ ਨਾ ਜੀ ਉਹਨਾਂ 'ਤੇ ਵੀ ਗਰੰਟੀ ਵਰੰਟੀ ਹੁੰਦੀ ਹੈ ਜੀ ਕੋਈ ਅੱਛਾ ਜੀ ਠੀਕ ਠੀਕ ਹੈ ਜੀ ਠੀਕ ਹੈ ਉਹ ਪਹਿਲਾਂ ਸਾਡੇ ਰਿਸ਼ਤੇਦਾਰੀ 'ਚੋਂ ਲੈ ਕੇ ਗਏ ਸੀ ਤੁਹਾਥੋਂ ਉਹਨਾਂ ਨੇ ਦੱਸਿਆ ਰਿਕਮੈਂਡ ਕਰਿਆ ਸੀ ਕਹਿੰਦੇ ਉੱਥੋਂ ਲਿਓ ਇੱਕ ਬੱਚਿਆਂ ਦੇ ਦੱਸੋ ਜੀ ਜੇ ਮਿਲ ਜਾਣਗੇ ਸਾਇਜ ਦਾ ਥੋੜ੍ਹਾ ਜਿਹਾ ਹੁੰਦਾ ਬੱਚਿਆਂ ਦਾ ਸਾਇਜ ਨਹੀਂ ਛੇਤੀ ਮਿਲਦਾ ਕਿਤੋਂ ਅੱਛਾ ਜੀ ਸਾਇਜ ਮੇਰੇ ਥੋੜ੍ਹਾ ਜਿਹਾ ਮੇਰੇ ਥੋੜ੍ਹਾ ਜਿਹਾ ਬੜਾ ਸਾਈਜ਼ ਆਉਂਦਾ ਜੀ ਮਤਲਬ ਦਸ ਦੇ ਨੇੜੇ ਤੇੜੇ ਉੱਪਰ ਹੀ ਆ ਜਾਂਦਾ ਮਿਲ ਜਾਣਗੇ ਜੀ ਸਾਈਜ਼ ਠੀਕ ਜੀ ਇੱਕ ਬੱਚਿਆਂ ਨਾ ਸਾਡੇ ਛੋਟਾ ਬੱਚਾ ਜੀ ਉਹ ਲਾਈਟਾਂ ਜਿਹੇ ਵਾਲੇ ਬੂਟ ਮੰਗਦਾ ਹੁੰਦਾ ਉਹ ਮਿਲ ਜਾਂਦੇ ਨੇ ਆਪਣੇ ਅੱਛਾ ਅੱਛਾ ਜੀ ਜ਼ਰੂਰ ਜ਼ਰੂਰ ਜ਼ਰੂਰ ਅਤੇ ਜੇ ਤਾਂ ਅਸੀਂ ਪੂਰੀ ਫੈਮਿਲੀ ਦੇ ਲੈਂਦੇ ਜੀ ਉਹਦੇ ਵਾਸਤੇ ਕੋਈ ਡਿਸਕਾਊਂਟ ਜੇ ਦਸ ਹਜ਼ਾਰ ਤੋਂ ਵੱਧ ਅੱਛਾ ਸਾਰਿਆਂ ਦੀ ਮਿਲਾ ਕੇ ਹੁੰਦੀ ਹੈ ਜੀ ਅ ਠੀਕ ਹੈ ਜੀ ਠੀਕ ਹੈ ਬਾਕੀ ਲੇਡੀ ਟੋਪ ਦਾ ਹੀ ਹੁੰਦਾ ਸਾਨੂੰ ਤਾਂ ਜ਼ਿਆਦਾ ਜੀ ਉਹ ਵੱਧ ਤੋਂ ਵੱਧ ਵਰਾਈਟੀ ਦੇਖਦੇ ਨੇ ਵੈਸੇ ਤਾਂ ਚੱਲ ਜਿਹੜਾ ਆ ਗਿਆ ਠੀਕ ਹੈ ਲੈ ਲਵਾਂਗੇ ਲੇਡੀ ਵਾਲਾ ਸਟੋਕ ਸਾਈਜ਼ ਸਾਰੇ ਮਿਲ ਜਾਣਗੇ ਜੀ ਆਪਣੇ ਕੋਲ ਠੀਕ ਹੈ ਜੀ ਠੀਕ ਹੈ ਕੀ ਐਡਰੈਸ ਆਪਣਾ ਕਿੱਥੇ ਜੇ ਪੈ ਜਾਂਦੀ ਦੁਕਾਨ ਇਹ ਸਟੇਸ਼ਨ ਵੱਲ ਨੂੰ ਜੀ ਕਿੱਧਰ ਨੂੰ ਅੱਛਾ ਜੀ

ਹਾਂਜੀ ਹਾਂਜੀ ਕੀ ਨਾਮ 'ਤੇ ਜੀ ਆਪਣੇ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਸ਼ਰਮਾ ਜੀ ਫਿਰ ਕੱਲ ਨੂੰ ਮਾਰਦੇ ਆ ਗੇੜਾ ਤੁਹਾਡੇ ਕੋਲ ਹੈਂ ਜੀ ਅੱਛਾ ਜੀ ਅੱਛਾ ਫੋਨ ਕਰਕੇ ਆਵਾਂਗੇ ਜੀ ਸਗੋਂ ਠੀਕ ਹੈ ਸਰ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ